ਬੈਂਕ ਤੋਂ ਇਲਾਵਾ ਅਸੀਂ ਅਗਰ ਮੁਸੀਬਤ ਦੇ ਸਮੇਂ ਕਰਜ਼ਾ ਲੈਣਾ ਹੋਵੇ ਜਾਂ ਸਾਨੂੰ ਪੈਸਾ ਚਾਹੀਦਾ ਹੋਵੇ ਤਾਂ ਅਸੀਂ ਕਿੱਥੋਂ ਉਧਾਰ ਲੈ ਸਕਦੇ ਹਾਂ ਇਸਦਾ ਮਤਲਬ ਇਹ ਹੈ ਕਿ ਇਹ ਜਿਵੇਂ ਗੈਰ ਸਰਕਾਰੀ ਸੰਸਥਾਵਾਂ ਹੁੰਦੀਆਂ ਐਨਜੀਓ ਬਣੀਆਂ ਹੁੰਦੀਆਂ ਆਪਾਂ ਉਹਨਾਂ ਨੂੰ ਆਪਣੀ ਪ੍ਰੋਬਲਮ ਦੱਸ ਕੇ ਪੈਸੇ ਆਪਣੇ ਉਹਨਾਂ ਤੋਂ ਆਪਣਾ ਕਰਜ਼ਾ ਲੈ ਸਕਦੇ ਹਾਂ ਕੁਛ ਕ ਸੰਸਥਾਵਾਂ ਇਹੋ ਜਿਹੀਆਂ ਹੁੰਦੀਆਂ ਹਨ ਜੋ ਆਪਣੀ ਮੁਸੀਬਤ ਨੂੰ ਸਮਝ ਕੇ ਔਰ ਆਪਣੇ ਡਾਕੂਮੈਂਟ ਵੈਰੀਫਿਕੇਸ਼ਨ ਕਰਵਾ ਕੇ ਆਪਾਂ ਨੂੰ ਪੈਸੇ ਵਰਤੋਂ ਕਰਨ ਲਈ ਦੇ ਦਿੰਦੇ ਹਨ ਸਾਡੀ ਮਦਦ ਕਰਦੀਆਂ ਹਨ ਔਰ ਕੁਛ ਕ ਗੈਰ ਸਰਕਾਰੀ ਸੰਸਥਾਵਾਂ ਇੱਦਾਂ ਦੀਆਂ ਹੁੰਦੀਆਂ ਹਨ ਜੋ ਕਿ ਥੋੜ੍ਹੇ ਟਾਈਮ ਲਈ ਜਾਂ ਕੋਈ ਟਾਈਮ ਪੀਰੀਅਡ ਹੋਏਗਾ ਓਨੇ ਲਈ ਆਪਾਂ ਨੂੰ ਘੱਟ ਵਿਆਜ 'ਤੇ ਪੈਸਾ ਉਧਾਰ ਦੇ ਦਿੰਦੀਆਂ ਹਨ ਅਤੇ ਇਸ ਤੋਂ ਇਲਾਵਾ ਅਸੀਂ ਧਾਰਮਿਕ ਅਸਥਾਨਾਂ ਤੋਂ ਵੀ ਆਪਣੀ ਮ ਮਦਦ ਦੀ ਗੁਹਾਰ ਲਗਾ ਸਕਦੇ ਹਾਂ ਜਿਵੇਂ ਕੋਈ ਚਰਚ ਗੁਰਦੁਆਰੇ ਜਾਂ ਮੰਦਰ ਤੋਂ ਆਪਾਂ ਇੱਦਾਂ ਆਪਣੀ ਭਾਈਚਾਰੇ ਦੇ ਤੌਰ 'ਤੇ ਆਪਾਂ ਪੈਸਾ ਉਧਾਰ ਲੈ ਸਕਦੇ ਹਾਂ ਗੈਰ ਸਰਕਾਰੀ ਸੰਸਥਾਵਾਂ ਜੋ ਹੁੰਦੀਆਂ ਹਨ ਇਹ ਕਈ ਭਾਈਚਾਰੇ ਦੇ ਨਾਲ ਮਤਲਬ ਕਿ ਦੋਸਤਾਂ ਮਿੱਤਰਾਂ ਦੇ ਨਾਲ ਸਹਿਯੋਗ ਦੇ ਨਾਲ ਬਣਦੀਆਂ ਹਨ ਅਤੇ ਇਹੀ ਸੰਸਥਾਵਾਂ ਲੋਕਾਂ ਦੀਆਂ ਬਹੁਤ ਮਦਦ ਕਰਦੀਆਂ ਹਨ ਅਤੇ ਉਹਨਾਂ ਨੂੰ ਮੁਸੀਬਤ ਦੇ ਸਮੇਂ ਵਿੱਚ ਪੈਸਾ ਜਾਂ ਰਾਸ਼ਨ ਪਾਣੀ ਦੀ ਸਹੂਲਤਾਂ ਦਿੰਦੀਆਂ ਹਨ